ਸਤਿ ਸ਼੍ਰੀ ਅਕਾਲ ਸਰ ਸਰ ਮੈਂ ਕਾਰਤਿਕ ਬੋਲ ਰਿਹਾ ਮੈਂ ਪਠਾਨਕੋਟ ਤੋਂ ਬੋਲਦਾ ਪਿਆ ਸਰ ਸਰ ਆਪਾਂ ਪਿਛਲੀ ਵਾਰ ਪੂਰੀ ਫੈਮਿਲੀ ਸਰ ਉੱਥੇ ਮੋਹਾਲੀ ਗਏ ਸੀ ਸਰ ਘੁੰਮਣ ਲਈ ਅਤੇ ਇਸ ਕਰਕੇ ਸਰ ਆਪਾਂ ਤੁਹਾਡੀ ਟੈਕਸੀ ਬੁੱਕ ਕੀਤੀ ਸੀ ਸਰ ਉਹ ਟੈਕਸੀ ਡਰਾਈਵਰ ਉਹ ਟੈਕਸੀ ਬਹੁਤ ਸਾਨੂੰ ਮਤਲਬ ਘਰਦਿਆਂ ਨੂੰ ਪਸੰਦ ਆਈ ਡਰਾਈਵਰ ਨਾ ਕੋਈ ਸਰ ਡਰਿੰਕ ਕਰਦਾ ਸੀ ਨਾ ਕੋਈ ਸਮੋਕ ਕਰਦਾ ਸੀ ਬਹੁਤ ਵਧੀਆ ਡਰਾਈਵਰ ਸੀਗਾ ਸਰ ਇਸ ਲਈ ਸਰ ਸਾਡੀ ਫਿਰ ਇੱਕ ਦੋ ਹਫਤੇ ਤੱਕ ਫਿਰ ਜਾਣ ਦੀ ਕੋਈ ਤਿਆਰੀ ਹੋ ਰਹੀ ਹੈ ਘਰਦਿਆਂ ਦੀ ਇਸ ਕਰਕੇ ਮੈਂ ਤੁਹਾਨੂੰ ਦੁਬਾਰਾ ਤੋਂ ਕਾਲ ਕੀਤੀ ਹੈ ਕਿ ਸਾਨੂੰ ਦੁਬਾਰਾ ਤੋਂ ਸੇਮ ਡਰਾਈਵਰ ਸੇਮ ਕਾਰ ਵਾਲਾ ਉਪਲਬਧ ਕੀਤਾ ਜਾਏ ਇਸ ਕਰਕੇ ਮੈਂ ਸਰ ਤੁਹਾਨੂੰ ਟਰੈਵਲ ਏਜੰਸੀ ਦੇ ਕੋਲ ਕੀਤਾ ਹੈ ਕਿ ਮੇਰੀ ਆਈਡੀ ਖੋਲ੍ਹ ਕੇ ਚੈੱਕ ਕੀਤੀ ਜਾਏ ਕਿ ਉਹ ਡਰਾਈਵਰ ਕਿਹੜਾ ਸੀ ਅਤੇ ਕਾਰ ਕਿਹੜੀ ਸੀ ਇਸ ਕਰਕੇ ਆਪਾਂ ਸਰ ਦੁਬਾਰਾ ਤੋਂ ਵੈਸ਼ਨੋ ਦੇਵੀ ਪਠਾਣਕੋਟ ਤੋਂ ਕਟਰਾ ਜਾਣਾ ਸਾਨੂੰ ਸਰ ਜਲਦੀ ਤੋਂ ਜਲਦੀ ਦੱਸਿਆ ਜਾਏ ਕਿਹੜਾ ਡਰਾਈਵਰ ਸੀ ਔਰ ਸਾਨੂੰ ਉਹਦੀ ਫੀਸ ਫੀਸ ਬਾਰੇ ਸਾਰਾ ਕੁਛ ਜਾਣਕਾਰੀ ਦਿੱਤੀ ਜਾਵੇ ਅਤੇ ਅਸੀਂ ਤੁਹਾਡੇ ਬਹੁਤ ਧੰਨਵਾਦੀ ਹੋਵਾਂਗੇ ਧੰਨਵਾਦ ਸਰ